ਹੈਲੋ ਸਤਿ ਸ਼੍ਰੀ ਅਕਾਲ ਜੀ ਓ ਹਾਂਜੀ ਹਾਂਜੀ ਠੀਕ ਹੈ ਮੈਂ ਕਰਦਾ ਫੋਲੋ ਤੁਹਾਨੂੰ ਹਾਂਜੀ ਹਾਂਜੀ ਬਹੁਤ ਵਧੀਆ ਮੈਂ ਫੋਲੋ ਕਰਦਾ ਤੁਹਾਨੂੰ ਤੁਹਾਡੇ ਵਲੋਗ ਦੇਖਦੇ ਰਹੀ ਦੇ ਆ ਹਾਂਜੀ ਹੁਸ਼ਿਆਰਪੁਰ ਚ ਅੱਛਾ ਜੀ ਇੱਥੇ ਕਾਫੀ ਬੇਕਰ ਹੈਗੀਆਂ ਨੇ ਅ ਮੀਨਜ ਸਭ ਤੋਂ ਵਧੀਆ ਤਾਂ ਸਰਤਾਜ ਬੇਕਰ ਦੀ ਹੈਗੀ ਆ ਉਹਨਾਂ ਦੀ ਫਰੈਂਚਾਈਜ਼ੀ ਹਾਂਜੀ ਲੁਧਿਆਣੇ ਦੇ ਜਿਹੜੇ ਇਹ ਹੈਗੀ ਜੀ ਸਤਾਰੀ ਰੋਡ 'ਤੇ ਪੈਣੀ ਤੁਹਾਨੂੰ ਸਤਾਰੀ ਰੋਡ ਜਦੋਂ ਸ਼ੈਸ਼ਨ ਚੌਂਕ ਤੋਂ ਹਾਂਜੀ ਹਾਂਜੀ ਹਾਂਜੀ ਗਵਰਨਮੈਂਟ ਕਾਲਜ ਗਵਰਨਮੈਂਟ ਕਾਲਜ ਤੋਂ ਪਿੱਛੇ ਹੈ ਚੰਡੀਗੜ ਰੋਡ ਤੋਂ ਤੁਸੀਂ ਸੈਸ਼ਨ ਚੌਂਕ ਜਾਣਾ ਸਿੱਧੇ ਸ਼ੈਸ਼ਨ ਚੌਂਕ ਤੋਂ ਸਿੱਧੇ ਜਾਣਾ ਕਿਸੇ ਨੂੰ ਵੀ ਪੁੱਛ ਲਿਓ ਆਨ ਰੋਡ ਹੀ ਆ ਲੈਫਟ ਹੈਂਡ ਸਾਈਡ ਦਿਖਣਾ ਤੁਹਾਨੂੰ ਕਾਫੀ ਵਧੀਆ ਹੈਗੇ ਸਰਤਾਜ ਬੇਕਰਸ ਉੱਥੇ ਠੀਕ ਹੈ ਉੱਥੇ ਇੱਕ ਤਾਂ ਜ਼ਿਆਦਾ ਮਸ਼ਹੂਰ ਤਾਂ ਉਹਨਾਂ ਦੇ ਕੇਕ ਪੇਸਟਰੀ ਵਗੈਰਾ ਹੀ ਹੈਗੇ ਆ ਅਤੇ ਹੋਰ ਵੀ ਅਤੇ ਇਹ ਉਹਨਾਂ ਦੀ ਹੀ ਕੁਆਲਟੀ ਆ ਫਰੈੱਸ਼ ਮਿਲਦਾ ਹਰੇਕ ਚੀਜ਼ ਕੋਈ ਵੀ ਤੁਸੀਂ ਚੀਜ਼ ਲਓਂਗੇ ਸਾਨੂੰ ਨਾਲ ਹੀ ਫਰੈੱਸ਼ ਮਿਲੂਗੀ ਤੁਸੀਂ ਅੱਧੇ ਘੰਟਾ ਪਹਿਲਾਂ ਓਡਰ ਦਿੰਦੇ ਹੋ ਨਾਲ ਹੀ ਮਿਲ ਜਾਊ ਫਰੈੱਸ਼ ਬਣਾ ਕੇ ਦਿੰਦੇ ਬਹੁਤ ਵਧੀਆ ਸਰਵਿਸ ਆ ਜੀ ਹੁਸ਼ਿਆਰਪੁਰ ਦੇ ਸਭ ਤੋਂ ਮਸ਼ਹੂਰ ਉਹੀ ਨੇ ਹੋਰ ਵੀ ਬੇਕਰਸ ਹੈਗੇ ਨੇ ਅਤੇ ਸਭ ਤੋਂ ਵਧੀਆ ਮੈਂ ਰਿਕਮੈਂਡ ਇਹੀ ਕਰਦਾ ਠੀਕ ਹੈ

ਨਹੀਂ ਉੱਥੇ ਟਰਾਈ ਕਰਿਓ ਐਕਸਪੀਰੀਐਂਸ ਐਕਸਪੀਰੀਐਂਸ ਮੈਂ ਤਾਂ ਉੱਥੋਂ ਆਪਾਂ ਹਰ ਕੋਈ ਵੀ ਬਰਥਡੇ ਪਾਰਟੀ ਘਰ ਫੰਕਸ਼ਨ ਹੋਵੇ ਮੈਂ ਉੱਥੋਂ ਕੇਕ ਲੈ ਕੇ ਆਉਂਦਾ ਪੇਸਟੀ ਜੋ ਓਡਰ ਕਰੀ ਦਾ ਹੁਣ ਤਾਂ ਰੀਸੈਂਟ ਹੀ ਇਹ ਹੀ ਹਫ਼ਤਾ ਕੁ ਹੋਇਆ ਅਜੇ ਉਸ ਦਿਨ ਮੇਰਾ ਬਰਡੇ ਸੀ ਮੇਰੇ ਬ੍ਰਦਰ ਦਾ ਅਤੇ ਮੈਂ ਸਿਰਫ ਵੀਹ ਕੁ ਮਿੰਟ ਪਹਿਲਾਂ ਹੀ ਗਿਆ ਉੱਥੇ ਉਹਨਾਂ ਨੂੰ ਕੇਕ ਦੀ ਫੋਟੋ ਦਿਖਾਈ ਕਿਹਾ ਇੱਦਾਂ ਦਾ ਕੇਕ ਚਾਹੀਦਾ ਉਹ ਵੀਹ ਮਿੰਟ 'ਚ ਰੈਡੀ ਕਰਕੇ ਉਹਨਾਂ ਨੇ ਮੈਨੂੰ ਦੇ ਤਾ ਹੋਮ ਡਿਲੀਵਰੀ ਵੀ ਹੈਗੀ ਆ ਇਹਨਾਂ ਦੀ ਹੋਮ ਡਿਲੀਵਰੀ ਵੀ ਹੈਗੀ ਆ ਐਕਸਟਰਾ ਚਾਰਜਸ ਨਹੀਂ ਹੈਗੇ ਵੀਹ ਮਿੰਟ ਦੇ ਵਿੱਚ ਵਿੱਚ ਹੋ ਜਾਂਦੀ ਹੈ ਡਲੀਵਰੀ ਨਾਲੇ ਵਧੀਆ ਬਹੁਤ ਵਧੀਆ ਅਤੇ ਟੇਸਟ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਬਹੁਤ ਵਧੀਆ ਆ ਅਤੇ ਟੇਸਟ ਜਿੱਦਾਂ ਦੀ ਪ੍ਰੈਜੈਂਟੇਸ਼ਨ ਆ ਉਤੋਂ ਹੋਰ ਵੀ ਵਧੀਆ ਟੇਸਟ ਅ ਹਰੇਕ ਚੀਜ਼ ਫਰੈਸ਼ ਹੋਣ ਕਾਰਨ ਲੱਗਦਾ ਖਾ ਕੇ ਹੀ ਪਤਾ ਲੱਗਦਾ ਕਿ ਹਾਂ ਵਧੀਆ ਤੁਸੀਂ

ਨਹੀਂ ਨਹੀਂ ਨਹੀਂ ਬਿਲਕੁਲ ਕੋਪਰੇਟਿੰਗ ਹੈਗੇ ਨੇ ਬਹੁਤ ਵਧੀਆ ਕੋਪਰੇਟਿੰਗ ਜੇ ਤੁਸੀਂ ਦੱਸੋਗੇ ਉਹਨਾਂ ਨੇ ਆਪੇ ਸਾਰਾ ਤੁਹਾਨੂੰ ਗਾਈਡ ਗਾਈਡ ਕਰੂਗੇ ਕਿ ਹਾਂ ਇਹਦੀ ਇਹਦੀ ਵੀਡੀਓ ਬਣਾਓ ਤੁਹਾਨੂੰ ਦੱਸੂਗੇ ਹਰੇਕ ਸਪੈਸ਼ਲਟੀ ਆਪਣੀ ਐੱਗਲੈਸ ਐੱਗਲੈਸ ਆ ਪਿਓਰ ਵੈੱਜ ਆ ਉੱਥੇ ਮੈਨੂੰ ਲੱਗਦਾ ਵੈੱਜ ਹਾਂਜੀ ਹਾਂਜੀ ਤਾਂ ਹੀ ਕਰਕੇ ਉਹ ਉਹਨਾਂ ਨੇ ਪਿਓਰ ਵੈਜ ਆ ਉਹਨਾਂ ਦਾ ਸਾਰਾ ਤਾਂ ਹੀ ਲੋਕ ਜ਼ਿਆਦਾ ਜਾਂਦੇ ਨੇ

ਓਕੇ ਜੀ ਥੈਂਕ ਯੂ ਥੈਂਕ ਯੂ ਕੋਈ ਗੱਲ ਨਹੀਂ